ਨਾਗਰਿਕ ਦੀ ਸੁਰੱਖਿਆ ਅਤੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਇਹ ਕਾਨੂੰਨ ਬਣਾਉਣੇ ਚਾਹੀਦੇ ਹਨ ਸੜਕ ਨੂੰ ਪਾਰ ਕਰਦੇ ਸਮੇਂ ਬੱਤੀਆਂ ਦਾ ਹੋਣਾ ਜ਼ਰੂਰੀ ਹੈ ਤੇਜ਼ ਸਾਨੂੰ ਵਾਹਨ ਨਹੀਂ ਭਜਾਉਣਾ ਚਾਹੀਦਾ ਵਾਹਨ ਨੂੰ ਚਲਾਉਂਦੇ ਸਮੇਂ ਹੈਲਮੰਟ ਪਹਿਨਣਾ ਜ਼ਰੂਰੀ ਹੈ ਵਾਹਨ ਚਲਾਉਂਦੇ ਸਮੇਂ ਆਪਾਂ ਨੂੰ ਫੋਨ 'ਤੇ ਗੱਲ ਨਹੀਂ ਕਰਨੀ ਚਾਹੀਦੀ ਭਾਰਤੀ ਸਿਵਲ ਡਿਫੈਂਕ ਕੋਡ ਦੋ ਹਜ਼ਾਰ ਤੇਈ ਕੋਡ ਆਫ ਕ੍ਰਿਮੀਨਰ ਪ੍ਰੋਸੀਜਰ ਉੱਨੀ ਸੌ ਤਿਹੱਤਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਸੀ ਸੀ ਆਰ ਪੀ ਸੀ ਗ੍ਰਿਫਤਾਰੀ ਮੁਕੱਦਮੇ ਅਤੇ ਜਮਾਂਦਰੂ ਲਈ ਪ੍ਰਕਿਰਿਆ ਪ੍ਰਦਾਨ ਕਰਦੀ ਹੈ ਸੱਤ ਸਾਲ ਵਿੱਚ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਲਈ ਫੋਰ ਫੋਰੈਸਿਕ ਜਾਂਚ ਦਾ ਹੁਕਮ ਦਿੱਤਾ ਹੈ ਫੋਰੈਸਿਕ ਮਾਹਰ ਫਰੈਸਿਕਸ ਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਰਿਕਾਰਡ ਕਰਨ ਲਈ ਅਪਰਾਧਿਕ ਦੇ ਦ੍ਰਿਸ਼ਾਂ ਦਾ ਦੌਰਾ ਕਰ ਕਰਨਾ ਚਾਹੀਦਾ ਹੈ ਸਾਰੇ ਟਰਾਇਲ ਪੁੱਛਗਿੱਛ ਅਤੇ ਕਾਰਵਾਈ ਇਲੈਕਟਰਿਕ ਮੂਡ ਵਿੱਚ ਕੀਤੀਆਂ ਜਾ ਰਹੀਆਂ ਹਨ ਇਲੈਕਟ੍ਰਿਕ ਸੰਚਾਰ ਯੰਤਰ ਜਿਹਨਾਂ ਨੂੰ ਡੀਜਲ ਸਬੂਤ ਹੋਣ ਦੀ ਸਮਰੱਥਾ ਹੈ ਨੂੰ ਜਾਂਚ ਪੁੱਛਗਿੱਛ ਦੇ ਮੁਕੱਦਮੇ ਦੌਰਾਨ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ